ਮੈਨੂੰ ਬੁਣਾਈ ਕਰਨਾ ਬਹੁਤ ਪਸੰਦ ਹੈ ਮੈਂ ਛੋਟੇ ਹੁੰਦਿਆਂ ਤੋਂ ਹੀ ਬੁਣਾਈ ਕਰਨ ਵਿੱਚ ਬਹੁਤ ਚੁਚੀ ਬਹੁਤ ਰੁਚੀ ਰੱਖਦੀ ਹਾਂ ਮੈਨੂੰ ਛੋ ਮੈਂ ਛੋਟੀ ਉਮਰ ਵਿੱਚ ਹੀ ਮੋ ਮੋਜ਼ੇ ਬਣਾਉਣਾ ਸਵੈਟਰ ਬਣਾਉਣਾ ਮੈਨੂੰ ਪਸੰਦ ਹੈ ਮੈਂ ਹਰ ਹਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਡਿਜ਼ਾਇਨ ਵੀ ਕਰ ਲੈਂਦੀ ਹਾਂ ਜੇਕਰ ਮੈਨੂੰ ਕੋਈ ਹੋਰ ਮਿਲਦਾ ਹੈ ਨਵੇਂ ਡਿਜ਼ਾਇਨ ਜਿਸ ਨੂੰ ਮੇਰੇ ਤੋਂ ਜ਼ਿਆਦਾ ਆਉਂਦੇ ਹਨ ਮੈਂ ਉਹਨਾਂ ਤੋਂ ਸਿੱਖ ਲੈਂਦੀ ਹਾਂ ਅਤੇ ਮੈਨੂੰ ਇਹ ਕਰਨਾ ਜ਼ਿਆਦਾ ਪਸੰਦ ਹੈ ਸਿਲਾਈ ਬੁਣਾਈ ਮੈਨੂੰ ਬਹੁਤ ਪਸੰਦ ਹੈ ਮੈਂ ਫਰੀ ਟਾਈਮ ਕੱਢ ਕੇ ਵੀ ਕਰ ਲੈਂਦੀ ਹਾਂ ਅਤੇ ਇਸ ਦੇ ਨਾਲ ਮੇਰਾ ਘਰ ਦਾ ਖਰਚਾ ਵੀ ਚੱਲ ਜਾਂਦਾ ਹੈ ਮੈਂ ਆਪਣੇ ਖੁਦ ਦੇ ਮੋਜ਼ੇ ਜਿਸ ਨੂੰ ਪੰਜਾਬ ਜੁਰਾਬਾਂ ਵੀ ਕਹਿੰਦੇ ਹਨ ਮੈਨੂੰ ਇਹ ਬਣਾ ਕੇ ਖੁਸ਼ੀ ਮਿਲਦੀ ਹੈ ਮੈਂ ਆਪਣੇ ਬੇਟੇ ਲਈ ਵੀ ਉਹ ਬਣਾ ਕੇ ਰੱਖਦੀ ਹਾਂ ਇਸ ਦੇ ਨਾਲ ਮੇ ਮੈਂ ਆਪਣੇ ਹੋਰ ਵੀ ਕਈ ਖਰਚੇ ਵੀ ਕੱਢ ਲੈਂਦੀ ਹਾਂ ਧੰਨਵਾਦ ਜੀ